ਪੀਟੀ ਊਸ਼ਾ ਭਾਰਤ ਦੀ ਅਥਲੈਟਿਕ ਸੀਗੀ ਹੈ ਨਾ ਵੀ ਉਹ ਐਨਾ ਕਹਿੰਦੇ ਆਂਏ ਤੁਫਾਨ ਵਾਂਗੂੰ ਭੱਜਦੀ ਹੁੰਦੀ ਸੀਗੀ ਉਹ ਪੂਰਾ ਐਵੇਂ ਵੀ ਬਹੁਤ ਤੇਜ਼ ਦੌੜਾਕ ਸੀਗੀ ਉਹ ਸੌ ਮੀਟਰ ਚਾਰ ਸੌ ਮੀਟਰ ਰੇਸਾਂ ਲਾਉਂਦੀ ਹੁੰਦੀ ਸੀਗੀ ਉਹ ਅਤੇ ਪੀਟੀ ਊਸ਼ਾ ਭਾਰਤ ਦੇ ਵਿੱਚੋਂ ਕੇਰਲਾ ਕੇਰਲਾ ਦੀ ਹੈਗੀ ਅਤੇ ਉ ਉਲੰਪਿਕ ਦੇ ਵਿੱਚ ਉਹ ਗੋਲਡ ਮੈਡਲ ਨਹੀਂ ਜਿੱਤ ਸਕੀ ਕਿਉਂਕਿ ਉਹਦੀ ਨਾ ਬਾਇਓਗ੍ਰਾਫੀ ਆਈ ਸੀਗੀ ਪੀਟੀ ਊਸ਼ਾ ਦੀ ਉਹ ਦੱਸ ਰਹੀ ਸੀਗੀ ਵੀ ਉਨ੍ਹਾਂ ਸਮਿਆਂ ਦੇ ਵਿੱਚ ਇੱਕ ਤਾਂ ਵੀ ਖਾਣ ਪੀਣ ਦਾ ਮੈਨੂੰ ਵੀ ਵਧੀਆ ਨਹੀਂ ਸੀ ਮਿਲਦਾ ਵੀ ਖਾਣੇ ਦੇ ਵਿੱਚ ਨਾ ਜਿਵੇਂ ਅੱਧਾ ਪਤਾ ਨਹੀਂ ਅੰਡੇ ਪਤਾ ਨਹੀਂ ਬੋਆਇਲ ਕਰਕੇ ਉਬਲੇ ਹੋਏ ਦਿੰਦੇ ਸੀ ਪਤਾ ਨਹੀਂ ਚਿਕਨ ਐਵੇਂ ਕੁਛ ਮਿਲਦਾ ਸੀ ਉਹ ਖਾਂਦੀ ਨਹੀਂ ਸੀਗੀ ਉਹ ਸਾਊਥ ਇੰਡੀਅਨ ਸੀ ਕੁੜੀ ਉਹ ਅਤੇ ਉਹ ਕਹਿੰਦੀ ਵੀ ਮੈਂ ਇਕੱਲੇ ਚੌਲ ਖਾਂਦੀ ਹੁੰਦੀ ਸੀਗੀ ਵੀ ਓਸ ਕਰਕੇ ਮੇਰੇ ਸਰੀਰਕ ਪੱਖੋਂ ਹੈ ਨਾ ਵੀ ਉਹਦੇ 'ਤੇ ਵੀ ਉਹਦੇ 'ਤੇ ਅਸਰ ਪਿਆ ਨਾ ਵੀ ਭੱਜ ਨਹੀਂ ਸਕੀ ਉਹ ਮਤਲਬ ਗੋਲਡ ਮੈਡਲ ਲਿਆ ਨਹੀਂ ਸਕੀ ਹੈਗੀ ਪਰ ਇਹਨੇ ਮਤਲਬ ਕਿ ਬਹੁਤ ਘੱਟੋਂ ਘੱਟ ਵੀ ਸੌ ਤੋਂ ਜ਼ਿਆਦਾ ਨਾ ਇਹਨੇ ਮਤਲਬ ਕਿ ਮੈ ਮੈਡਲ ਜਿੱਤੇ ਨੇ ਇੱਕ ਸੌ ਇੱਕ ਪਤਾ ਨਹੀਂ ਕਿੰਨੇ ਮੈਡਲ ਮਿਲੇ ਨੇ ਇਹਨੂੰ ਅਤੇ ਪਟ ਜਿਹੜੀਆਂ ਜਿਹੜੀਆਂ ਮਤਲਬ ਕੇ ਜਿਹੜੀਆਂ ਏਸ਼ਿਆਈ ਗੇਮਾਂ ਹੋਈਆਂ ਸੀਗੀਆਂ ਉਹਦੇ ਵਿੱਚ ਇਹਨੇ ਚਾਰ ਗੋਲਡ ਮੈਡਲ ਜਿੱਤੇ ਸੀਗੇ ਬੇਸ਼ੱਕ ਵੀ ਆਪਣੇ ਭਾਰਤ ਦਾ ਗੋਲਡ ਮੈਡਲ ਨਹੀਂ ਮਿਲਿਆ ਹੈਗਾ ਪਰ ਫਿਰ ਵੀ ਉਨ੍ਹਾਂ ਇੱਕ ਆਮ ਕੁੜੀਆਂ ਲਈ ਹੈ ਨਾ ਵੀ ਬਹੁਤ ਵੱਡੀ ਆਪਾਂ ਕਹਿ ਸਕਦੇ ਹਾਂ ਨਾ ਵੀ ਆਪਾਂ ਨੂੰ ਮਤਲਬ ਕਿ ਇੱਕ ਸ ਕਹਿ ਸਕਦੇ ਹੈਗੇ ਵੀ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈਗਾ ਉਹਨੂੰ ਦੇਖ ਕੇ ਵੀ ਇੱਕ ਔਰਤ ਹੋਣ ਦੇ ਬਾਵਜੂਦ ਕਿਵੇਂ ਉਹਨੇ ਗ੍ਰਹਿਸਥ ਜੀਵਨ ਦੇ ਨਾਲ ਨਾਲ ਹੈ ਨਾ ਫਿਰ ਉਹ ਵਿਆਹ ਤੋਂ ਬਾਅਦ ਫਿਰ ਉਹ ਇੱਧਰ ਖੇਡਾਂ ਦੇ ਵਿੱਚ ਦੁਬਾਰਾ ਫਿਰ ਵਾਪਸ ਮੁੜੀ ਹੈ ਨਾ ਹੁਣ ਅੱਜ ਵੀ ਮਤਲਬ ਕਿ ਉਹ ਕੁੜੀਆਂ ਨੂੰ ਕੀ ਹੈ ਸਿੱਖਿਆ ਦੇ ਰਹੀ ਹੈ ਨਾ ਵੀ ਇੱਕ ਔਰਤ ਹੋ ਕੇ ਅਤੇ ਇੱਕ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਨਾ ਕਿ ਪਹਿਲੀ ਵਾਰੀ ਉਹ ਆਪਣੀ ਇੱਕ ਨਾ ਸੰਸਥਾ ਹੈਗੀ ਵੀ ਇਹ ਭਾਰਤੀ ਉਲੰਪਿਕ ਐਸੋਸੀਏਸ਼ਨ ਹੈ ਉਹਦੀ ਉਹ ਪਹਿਲੀ ਵਾਰੀ ਇੱਕ ਔਰਤ ਮਤਲਬ ਬਣੀ ਹੈਗੀ ਪ੍ਰਧਾਨ ਬਣੀ ਹੈ ਇਸ ਤੋਂ ਪਹਿਲਾਂ ਮਹਾਰਾਜਾ ਭੁਪਿੰਦਰ ਸਿੰਘ ਰਹੇ ਨੇ ਉੱਨੀ ਸੌ ਸੱਠ ਤੱਕ ਉਸ ਤੋਂ ਬਾਅਦ ਇਹ ਬਣੀ ਹੈਗੀ ਚੁਰਾਸੀ ਦੇ ਵਿੱਚ ਜਿਹੜੀਆਂ ਉਲੰਪਿਕ ਦੀਆਂ ਹੋਈਆਂ ਸੀਗੀਆਂ ਖੇਡਾਂ ਸੀਗੀਆਂ ਤਾਂ ਉਹਦੇ ਵਿੱਚ ਇਹਨੇ ਮਤਲਬ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀਗਾ ਬੇਸ਼ੱਕ ਚਲੋ ਗੋਲਡ ਮੈਡਲ ਨਹੀਂ ਮਿਲਿਆ ਪਰ ਫਿਰ ਵੀ ਬਹੁਤ ਵਧੀਆ ਮਤਲਬ ਕਹਿ ਸਕਦੇ ਹਾਂ ਵੀ ਆਪਾਂ ਨੂੰ ਸਿੱਖਿਆ ਮਿਲਦੀ ਹੈਗੀ ਐ ਇਨ੍ਹਾਂ ਨੂੰ ਦੇਖ ਕੇ ਇੰਨੀ ਹਿੰਮਤ ਐਨਾ ਹੌਂਸਲਾ ਹੈ ਨਾ ਐਨਾ ਜਜ਼ਬਾ ਸੀਗਾ ਦੇਸ਼ ਨੂੰ ਲੈ ਕੇ ਹੈ ਨਾ ਆਪਦੇ ਕਿਵੇਂ ਉਹ ਇੱਕ ਛੋਟੇ ਜਿਹੇ ਖੇਤਰ ਤੋਂ ਹੈ ਨਾ ਕਿੱਥੇ ਜਾ ਕੇ ਪਹੁੰਚੀ ਅਤੇ ਮਤਲਬ ਕਿ ਪ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਅਤੇ ਅਰਜੁਨ ਅਵਾਰਡ ਵੀ ਦਿੱਤਾ ਹੋਇਆ ਹੈਗਾ ਅਤੇ ਇਸ ਮੈਨੂੰ ਤਾਂ ਮਤਲਬ ਕਿ ਇੱਕ ਔਰਤ ਹੋਣ ਦੇ ਨਾਤੇ ਬਹੁਤ ਖੁਸ਼ੀ ਹੁੰਦੀ ਹੈ ਵੀ ਜਦੋਂ ਕਿ ਇੱਕ ਔਰਤ ਹੈ ਨਾ ਕਿੱਥੇ ਤੋਂ ਕਿੱਥੇ ਪਹੁੰਚਦੀ ਹੈਗੀ ਤਾਂ ਇੱਕ ਬਹੁਤ ਵੱਡੀ ਆਪਣੇ ਸਾਰਿਆਂ ਲਈ ਇੱਕ ਮਤਲਬ ਕਿ ਸ਼ਲਾਘਾਯੋਗ ਮਤਲਬ ਕਹਿ ਸਕਦੇ ਉਹ ਆਪਣੇ ਲਈ ਇੱਕ ਵੀ ਉਹ ਇੱਕ ਇੰਸਪੀਰੇਸ਼ਨ ਦਾ ਇੱਕ ਆਪਾਂ ਇੱਕ ਕਹਿ ਦਿੰਦੇ ਇੱਕ ਸਰੋਤ ਹੈਗੀ ਨਾ ਆਪਾਂ ਨੂੰ ਵੀ ਉਹ ਹੁੰਦੀ ਆ ਉਹਨੂੰ ਦੇਖ ਕੇ ਜਦੋਂ ਆਪਾਂ ਨੂੰ ਅੱਗੇ ਵਧਣ ਦਾ ਇੱਕ ਮੌਕਾ ਆਪ ਕਹਿ ਦਿੰਦੇ ਉਹਨੂੰ ਦੇਖ ਕੇ ਆਪਾਂ ਨੂੰ ਖੁਸ਼ੀ ਹੁੰਦੀ ਹੈ ਵੀ ਆਪਾਂ ਵੀ ਅੱਗੇ ਵਧੀਏ ਉਹਨੂੰ ਦੇਖ ਦੇਖ ਕੇ